ਉੱਨੀ ਅਗਸਤ ਉੱਨੀ ਸੌ ਚੋਂਹਠ ਪੰਜ ਨਵੰਬਰ ਉੱਨੀ ਸੌ ਸਤੱਤਰ ਇੱਕ ਜੂਨ ਉੱਨੀ ਸੌ ਚੁਰਾਸੀ ਤੇਰਾਂ ਫਰਵਰੀ ਦੋ ਹਜ਼ਾਰ ਛੇ ਸੱਤ ਮਈ ਦੋ ਹਜ਼ਾਰ ਇੱਕ